ਹਾਈਕ ਕਰਨ ਲਈ ਮੈਨੂੰ ਪਹਾੜਾਂ 'ਚ ਜਾਣਾ ਬਹੁਤ ਹੀ ਪਸੰਦ ਹੈ ਜ਼ਿਆਦਾਤਰ ਮੈਨੂੰ ਮੈਕਲੋਡਗੰਜ ਅਤੇ ਤ੍ਰਿਊਂਡ ਜਿੱਥੇ ਕਿ ਹਾਈਕਿੰਗ ਕਰਨ 'ਚ ਬੜਾ ਹੀ ਮਜ਼ਾ ਆਉਂਦਾ ਹੈ ਉੱਥੇ ਜਾ ਕੇ ਸਾਨੂੰ ਇੰਨੇ ਪੇੜ ਪੌਦੇ ਹੁੰਦੇ ਆ ਕਿ ਸਾਨੂੰ ਫ ਫਰੈਸ਼ ਏਅਰ ਉੱਥੋਂ ਮਿਲਦੀ ਹੈ ਔਕਸੀਜਨ ਸਾਹ ਲੈਣਾ ਸੌਖਾ ਹੁੰਦਾ ਇੱਦਾਂ ਲੱਗਦਾ ਕਿ ਸਾਨੂੰ ਕਿੰਨੀਆਂ ਬਿਮਾਰੀਆਂ ਸਾਡੀਆਂ ਦੂਰ ਹੋ ਜਾਣਗੀਆਂ ਜੇ ਅਗਰ ਅਸੀਂ ਉੱਥੇ ਪਹਾੜਾਂ ਵਿੱਚ ਰਹੀਏ ਹਾਈਕਿੰਗ ਕਰਨ ਵਾਸਤੇ ਪਹਾੜਾਂ ਤੋਂ ਜ਼ਿਆਦਾ ਅੱਛੀ ਜਗ੍ਹਾ ਮੈਂ ਨਹੀਂ ਲੱਗਦਾ ਮੈਨੂੰ ਨਹੀਂ ਲੱਗਦਾ ਕਿ ਅਸੀਂ ਹੋਰ ਦੱਸ ਸਕਦੇ ਹਾਂ